ਸਤਿ ਸ਼੍ਰੀ ਅਕਾਲ ਜੀ ਤੁਸੀਂ ਫੁਰਸਤ ਰੈਸਟੋਰੈਂਟ ਤੋਂ ਬੋਲਦੇ ਓਂ ਮੈਂ ਨਾ ਇੱਕ ਪੀਜ਼ਾ ਔਡਰ ਕੀਤਾ ਸੀ ਉਹ ਡਿਲੀਵਰੀ ਬੋਆਏ ਕਹਿੰਦਾ ਸੀ ਮੈਂ ਵੀਹ ਕੁ ਮਿੰਟ ਤੱਕ ਪਹੁੰਚਦਾ ਪਰ ਉਹ ਹਾਲੇ ਤੱਕ ਆਇਆ ਨਹੀਂ ਜੀ ਪੱਚੀ ਤੀਹ ਮਿੰਟ ਹੋ ਗਏ ਮੈਨੂੰ ਕਿਰਪਾ ਕਰਕੇ ਦੱਸਿਆ ਜਾਵੇ ਕਿ ਹੋਰ ਕਿੰਨਾ ਸਮਾਂ ਲੱਗਣਾ ਕਿਉਂਕਿ ਮੇਰੇ ਹਸਬੈਂਡ ਨੇ ਜਾਣਾ ਸੀ ਉਹਨਾਂ ਨੂੰ ਕਾਹਲ਼ ਸੀ ਕਿਰਪਾ ਕਰਕੇ ਛੇਤੀ ਦੱਸਿਆ ਜਾਵੇ ਧੰਨਵਾਦ ਜੀ